ਫਤਿਹਗੜ੍ਹ ਸਾਹਿਬ ਦੇ ਅੰਦਰ ਹੁਣ ਮੌਜੂਦਾ ਸੀ ਜਿਹੜੀ ਆਈ ਏ ਐੱਸ ਔਫਿਸਰ ਡੀ ਸੀ ਚੁਣੇ ਗਏ ਹਨ ਉਹ ਸੁਰਭੀ ਮਲਿਕ ਹੈ ਅਤੇ ਇਥੋਂ ਦੇ ਐੱਸ ਡੀ ਐੱਮ ਔਫਿਸਰ ਸਰਦਾਰ ਹਰਪ੍ਰੀਤ ਸਿੰਘ ਜੀ ਅਟਵਾਲ ਹਨ ਬਾਕੀ ਜਿਹੜੇ ਇੱਥੇ ਜ਼ਿਆਦਾ ਜਾਣੇ ਜਾਂਦੇ ਨੁਮਾਇੰਦੇ ਇਥੋਂ ਦੇ ਵਿਧਾਇਕ ਜਿਹੜੇ ਹੁਣੇ ਹੋ ਕੇ ਹਟੇ ਸੀ ਇਸ ਵਾਰ ਸ਼ਾਇਦ ਨਹੀਂ ਹਨ ਉਹ ਸੀ ਕਾਂਗਰਸ ਵੱਲੋਂ ਚੁਣੇ ਗਏ ਸਰਦਾਰ ਨਾਗਰਾ ਜੀ ਨਾਗਰਾ ਨੇ ਫਤਿਹਗੜ੍ਹ ਸਾਹਿਬ ਲਈ ਬੜਾ ਹੀ ਕੰਮ ਕੀਤਾ ਇੱਥੇ ਬੜੇ ਬੜੇ ਸਟੈਚੂ ਲਗਵਾਏ ਅਤੇ ਇੱਥੋਂ ਦੀ ਵਹਿੰਦੀਆਂ ਕੋਲ ਦੀਆਂ ਨਦੀਆਂ ਉਹਨਾਂ ਨੂੰ ਵੀ ਬੜਾ ਡਿਵੈਲਪ ਕਰਵਾਇਆ ਸੜਕਾਂ ਮੁੜੇ ਨਵੀਂ ਤੌਰ 'ਤੇ ਬਣਵਾਈਆਂ ਅਤੇ ਫਤਿਹਗੜ੍ਹ ਸਾਹਿਬ ਦੀ ਰੂਪ ਰੇਖਾ ਨੂੰ ਬਦਲਣ ਦੇ ਵਿੱਚ ਉਹਨਾਂ ਨੇ ਬੜਾ ਯੋਗਦਾਨ ਪਾਇਆ ਜਿਹਦੇ ਕਰਕੇ ਉਹ ਲੋਕਾਂ ਦੇ ਵਿੱਚ ਬੜੇ ਹੀ ਹਰਮਨ ਪਿਆਰੇ ਹੋ ਗਏ ਸਨ